ਮੈਂ ਸਕੂਲ ਵਿੱਚ ਪੜ੍ਹਾਉਂਦੀ ਹਾਂ ਅਤੇ ਸਕੂਲ ਦੇ ਵਿਦਿਆਰਥੀ ਕਲਾ ਅਤੇ ਸ਼ਿਲਪਕਾਰੀ ਵੀ ਸਿਖਾਉਂਦੀ ਹਾਂ ਸ਼ਿਲਪਕਾਰੀ ਮਤਲਬ ਕਿ ਡਰਾਇੰਗ ਡਰਾਇੰਗ ਵਗੈਰਾ ਦਾ ਪੀਰੀਅਡ ਮੈਂ ਹਰ ਸ਼ਨੀਵਾਰ ਅਤੇ ਸ਼ਨੀਵਾਰ ਲਗਾਉਂਦੀ ਹਾਂ ਅਤੇ ਬੱਚੇ ਬਹੁਤ ਅੱਛੀ ਡਰਾਇੰਗ ਬਣਾਉਂਦੇ ਆ ਪਹਿਲੇ ਮੈਂ ਬਲੈਕ ਬੋਰਡ 'ਤੇ ਉਹਨਾਂ ਨੂੰ ਟਰੇਸ ਕਰਕੇ ਦੱਸ ਦੀ ਹਾਂ ਕਿ ਕਿੱਦਾਂ ਤੁਸੀਂ ਟਰੇਸ ਕਰਨਾ ਅਤੇ ਕਿੱਦਾਂ ਕੀ ਕਰਨਾ ਜੇ ਬਹੁਤ ਵਧੀਆ ਉਹ ਬਲੈਕ ਬੋਰਡ ਤੋਂ ਦੇਖ ਕੇ ਬਹੁਤ ਵਧੀਆ ਕਰ ਸਕਦੇ ਹੈ ਇਸ ਕਲਾ ਅਤੇ ਸ਼ਿ ਸ਼ਿਲਪਕਾਰੀ ਸੰਬੰਧੀ ਮੇਰੀ ਜ ਬਚਪਨ ਦੀ ਯਾਦ ਬਹੁਤ ਜ਼ਿਆਦਾ ਤਾਜ਼ਾ ਹੋ ਜਾਂਦੀ ਹੈ ਜਿਵੇਂ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਅਤੇ ਬਰਸਾਤ ਪੈਂਦੀ ਸੀ ਅਸੀਂ ਮੀਂਹ ਦੇ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਸੁੱਟਦੇ ਹੁੰਦੇ ਸੀ ਅਤੇ ਵੇਖਦੇ ਹੁੰਦੇ ਸੀ ਸਾਰੇ ਕੀ ਕਿਹਦੀ ਕਿਸ਼ਤੀ ਜ਼ਿਆਦਾ ਵਧੀਆ ਜ਼ਿਆਦਾ ਵਧੀਆ ਚੱਲਦੀ ਹੈ ਜ਼ਿਆਦਾ ਵਧੀਆ ਬਣਦੀ ਅਤੇ ਕਿਹਦੀ ਕਿਸ਼ਤੀ ਸਭ ਤੋਂ ਅੱਗੇ ਗਈ ਹੈ ਇਸ ਕਰਕੇ ਜਿਹੜੇ ਇਹ ਸ਼ਿਲਪਕਾਰੀ ਅਤੇ ਕਲਾ ਜਿਹੜੀ ਸਿਖਾਉਂਦੀ ਆ ਉਹ ਬਹੁਤ ਹੀ ਵਧੀਆ ਸਿਖਾਉਂਦੇ ਉਹ ਸਾਡੇ ਸਕੂਲ ਵਿੱਚ ਸਾਡੇ ਸਕੂਲ ਦੇ ਵਿੱਚ ਜਿਹੜੇ ਸ਼ਿਲਪਕਾਰੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਜਿੱਦਾਂ ਕਿ ਕਿਸੇ ਨੂੰ ਡਰਾਇੰਗ ਵਗੈਰਾ ਲਗਾ ਦਿੱਤੀ ਜਾਂਦੀ ਹੈ ਕੋਈ ਡਰਾਇੰਗ ਬੁੱਕ ਦੇ ਦਿੱਤੀ ਜਾਂਦੀ ਹੈ ਜਿਹਦੇ ਉਹਦੇ ਉਤੇ ਉਹ ਕਲਾ ਵਗੈਰਾ ਬਣ ਬਣਾ ਕੇ ਸਾਨੂੰ ਦਿਖਾਉਂਦੇ ਹਨ ਅਤੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਕਿੱਥੋਂ ਠੀਕ ਹੈ ਅਤੇ ਕਿੱਥੋਂ ਨਹੀਂ ਠੀਕ ਹੈਗੀ ਅਤੇ ਉਹਨਾਂ ਨੂੰ ਦੁਬਾਰਾ ਟ੍ਰੇਸ ਕਰਕੇ ਦੱਸਦੀ ਹਾਂ ਕਿ ਇਹ ਚੀਜ਼ ਇੱਦਾਂ ਬਣਾਈ ਜਾਂਦੀ ਹੈ ਅਤੇ ਉਹ ਉਸ ਤਰ੍ਹਾਂ ਹੀ ਬਣਾਉਂਦੇ ਆ ਕਲਾ ਦੇ ਵੀ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਕਾਫੀ ਨਿਪੁੰਨ ਹਨ ਜੇ ਅਸੀਂ ਉਹਨਾਂ ਨੂੰ ਕਲਾ ਅਤੇ ਸ਼ਿਲਪਕਾਰੀ ਸਿਖਾਉਂਦੇ ਹਾਂ ਤਾਂ ਉਹ ਸਾਨੂੰ ਵੀ ਉਸ ਤਰ੍ਹਾਂ ਹੀ ਕਲਾ ਅਤੇ ਸ਼ਿਲਪਕਾਰ ਬਣਾ ਕੇ ਦੱਸਦੇ ਹਨ ਕਿ ਤੁਸ ਤੁਹਾਡਾ ਸਿਖਾਇਆ ਹੋਇਆ ਅਸੀਂ ਸਿੱਖਿਆ ਉਹ ਬਹੁਤ ਹੀ ਵਧੀਆ ਪੇਟਿੰਗ ਕਰਕੇ ਸਾਨੂੰ ਦੱਸ ਦਿੰਦੀ ਆ ਅਤੇ ਸਕੈਚ ਵਗੈਰਾ ਬਹੁਤ ਸੋਹਣੇ ਬਹੁਤ ਸੋਹਣੇ ਰੰਗਾਂ ਦਾ ਉਪਯੋਗ ਕਰਦੀਆਂ ਹਨ ਤਾਂ ਕਿ ਉਹ ਬਹੁਤ ਉੱਭਰ ਕੇ ਸ਼ਿਲਪਕਾਰੀ ਸਾਡੇ ਸਾਹਮਣੇ ਆਉਂਦੀ ਹੈ ਅਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕੀ ਸਾਡੀ ਸ਼ ਸਖਾਈ ਹੋਈ ਸ਼ਿਲਪਕਾਰੀ ਕਾਫੀ ਅੱਗੇ ਤੱਕਣ ਜਾ ਰਹੀ ਹੈ